ਨਹੀਂ ਸਾਡੇ ਪਿੰਡ ਵਿੱਚ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉਣ ਲਈ ਕਿਸੇ ਦੀ ਦੇਵਤਿਆਂ ਦੀ ਪੂਜਾ ਨਹੀਂ ਕੀਤੀ ਜਾਂਦੀ ਅਤੇ ਡਾਕਟਰ ਨੂੰ ਸੱਦਿਆ ਜਾਂਦਾ ਹੈ ਮੈਂ ਪਿੰਡ ਵਿੱਚ ਦੇਖਿਆ ਕਿ ਜਿਆਦਾ ਤੋਂ ਜਿਆਦਾ ਲੋਕ ਖੁਦ ਈ ਦੇਸੀ ਅਤੇ ਅੰਗਰੇਜ਼ੀ ਦਵਾਈਆਂ ਨਾਲ ਇਲਾਜ ਕਰਦੇ ਹਨ ਅਤੇ ਡਾਕਟਰ ਨੂੰ ਬੁਲਾ ਕੇ ਇਲਾਜ ਕਰਵਾਉਂਦੇ ਹਨ ਇਹੋ ਜਿਹੀ ਉਹਦੇ ਵਿਸ਼ਵਾਸ਼ਾ ਨਾਲ ਪਸ਼ੂ ਠੀਕ ਨਹੀਂ ਹੁੰਦੇ ਸਗੋਂ ਬਿਮਾਰ ਹੋ ਜਾਂਦੇ ਹਨ ਅਤੇ ਇਹ ਸਭ ਦੇ ਵਿਸ਼ਵਾਸ ਹੀ ਹਨ ਅੱਜ ਕੱਲ ਇਹਨਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਅਤੇ ਮੇਰਾ ਮੰਨਣਾ ਇਹੀ ਹੈ ਕਿ ਦਵਾਈਆਂ ਨਾਲ ਹੀ ਪਸ਼ੂ ਠੀਕ ਹੁੰਦੇ ਹਨ ਅਜਿਹੇ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਪਸ਼ੂ ਠੀਕ ਨਹੀਂ ਹੁੰਦੇ